ਟੈਕਨੋਲੋਜੀ ਨੇ ਟਰਾਂਸਪੋਰਟੇਸ਼ਨ ਨੂੰ ਬਹੁਤ ਹੀ ਆਸਾਨ ਬਣਾ ਦਿੱਤਾ ਹੈ ਜੇਕਰ ਪਹਿਲਾਂ ਸਾਨੂੰ ਕਿਤੇ ਜਾਣ ਲਈ ਸੌ ਵਾਰ ਸੋਚਣਾ ਪੈਂਦਾ ਸੀ ਕਿ ਅਸੀਂ ਕਿਵੇਂ ਜਾਵਾਂਗੇ ਕਿਹੜੀ ਬੱਸ ਜਾਂਦੀ ਹੈ ਕਿੱਥੇ ਰਹਾਂਗੇ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਹੁਣ ਇਹ ਸਭ ਕੁਝ ਬਿਲਕੁਲ ਆਸਾਨ ਹੋ ਗਿਆ ਹੈ ਜੇਕਰ ਅਸੀਂ ਘਰ ਬੈਠ ਕੇ ਕਿਤੇ ਜਾਣ ਦੀ ਸੋਚਦੇ ਹਾਂ ਤਾਂ ਅਸੀਂ ਔਨਲਾਈਨ ਟਿਕਟ ਦੀ ਬੁਕਿੰਗ ਕਰਕੇ ਆਸਾਨੀ ਨਾਲ਼ ਉੱਤੇ ਜਾਣ ਲਈ ਤਿਆਰ ਹੋ ਜਾਂਦੇ ਹਾਂ ਅਤੇ ਹੁਣ ਸਾਨੂੰ ਉੱਥੇ ਜਾ ਕੇ ਕਿਸੇ ਹੋਟਲ ਵਿੱਚ ਰਹਿਣ ਲਈ ਵੀ ਉੱਥੇ ਜਾ ਕੇ ਹੋਟਲ ਦੀ ਬੁਕਿੰਗ ਨਹੀਂ ਕਰਨੀ ਪੈਂਦੀ ਸਗੋਂ ਅਸੀਂ ਔਨਲਾਈਨ ਵੀ ਹੋਟਲ ਦੀ ਬੁਕਿੰਗ ਕਰ ਸਕਦੇ ਹਾਂ ਜਿਸ ਨਾਲ਼ ਕਿ ਸਾਡੀ ਯਾਤਰਾ ਬਹੁਤ ਸੁਖਤ ਹੋ ਜਾਂਦੀ ਹੈ ਅਤੇ ਸਾਨੂੰ ਟੈਂਸ਼ਨ ਵੀ ਬਹੁਤ ਘੱਟ ਹੋ ਜਾਂਦੀ ਹੈ